ਨਹੀਂ ਮੈਂ ਰੈਸਪੀ ਦੀ ਬਿਲਕੁਲ ਪਾਲਣਾ ਨਹੀਂ ਕਰਦੀ ਕਿਉਂਕਿ ਅਸੀਂ ਦੇਖ ਲੈਂਦੇ ਹਾਂ ਦੂਜਿਆਂ ਦੇ ਸਵਾਦ ਦੇ ਅਧਾਰ 'ਤੇ ਇਹਦੇ 'ਚ ਕੀ ਕੀ ਇਮਪਰੂਵਮੈਂਟ ਹੋ ਸਕਦੀਆਂ ਨੇ ਹੈ ਨਾ ਜਿਵੇਂ ਕਈਆਂ ਨੂੰ ਮਿੱਠਾ ਪਸੰਦ ਆ ਕਈਆਂ ਨੂੰ ਨਮਕ ਪਸੰਦ ਆ ਫਿਰ ਜਿਵੇਂ ਜਿਨਾਂ ਨੂੰ ਨਮਕ ਪਸੰਦ ਆ ਜੇ ਮਿੱਠੇ ਵਾਲੀ ਕੋਈ ਚੀਜ਼ ਬਣਾਉਣੀ ਆ ਉਹ ਮਿੱਠਾ ਥੋੜ੍ਹਾ ਜਿਹਾ ਘੱਟ ਪਾ ਦਿੰਦੇ ਆ ਇਹ ਸਾਰੀਆਂ ਚੀਜ਼ਾਂ ਨੇ ਅਸੀਂ ਹੈ ਨਾ ਉਹਨੂੰ ਇੱਕ ਸਵਾਦ ਦੇ ਅਧਾਰ 'ਤੇ ਵੀ ਲਗਾ ਲੋ ਜਾਂ ਉਹਦੇ ਵਿੱਚ ਜਿਹੜੇ ਨਿਊਟਰੀਐਂਟਸ ਨੇ ਵੱਧ ਖਾਣੇ ਦੇ ਵਿੱਚ ਜਿਨਾਂ ਦਾ ਸਾਡੀ ਸਿਹਤ ਨੂੰ ਫਾਇਦਾ ਹੋਵੇ ਉਹ ਅਸੀਂ ਜ਼ਿਆਦਾ ਪਾਉਦੇ ਆ ਉਹਦੇ ਵਿੱਚ ਹੈ ਨਾ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾਲੇ ਉਹਦੇ ਨਾਲ ਵਧੀਆ ਤਾਂ ਬਣਦੀਓ ਬਣਦੀ ਸਵਾਦਲੀ ਚੀਜ਼ ਬਣਦੀ ਵੀ ਆ ਅਤੇ ਸਾਡੇ ਸਰੀਰ ਨੂੰ ਜੇ ਉਹਨਾਂ ਨੂੰ ਸਾਡੀ ਸਿਹਤ ਨੂੰ ਇਮਪਰੂਵਮੈਂਟ ਆਉਣ ਆਵੇਗੀ ਤਾਂਹੀਓ ਅਸੀਂ ਹੈ ਨਾ ਵੀ ਉਹ ਚੀਜ਼ ਖਾਣ ਦਾ ਫਾਇਦਾ ਹੋਵੇਗਾ